ਸਤਿ ਸ਼੍ਰੀ ਅਕਾਲ ਮੇਰਾ ਨਾਂ ਸਿਮਰਜੀਤ ਸਿੰਘ ਹੈ ਅਤੇ ਮੈਂ ਗੜਬਾਗਾ ਪਿੰਡ ਦਾ ਰਹਿਣ ਵਾਲਾ ਹਾਂ ਅਸੀਂ ਤੁਹਾਡੇ ਕੋਲੋਂ ਇੱਕ ਘੰਟੇ ਕੁ ਪਹਿਲਾਂ ਸ਼ਾਹੀ ਪਨੀਰ ਅਤੇ ਤੰਦੂਰੀ ਰੋਟੀਆਂ ਦਾ ਆਰਡਰ ਦਿੱਤਾ ਸੀ ਅਤੇ ਤੁਹਾਡੇ ਢਾਬੇ ਦਾ ਪਨੀਰ ਬਹੁਤ ਹੀ ਸਵਾਦ ਹੁੰਦਾ ਹੈ ਅਸੀਂ ਤੁ ਤੁਹਾਡੇ ਢਾਬੇ ਤੋਂ ਹਮੇਸ਼ਾਂ ਹੀ ਸ਼ਾਹੀ ਪਨੀਰ ਅਤੇ ਤੰਦੂਰੀ ਰੋਟੀਆਂ ਦਾ ਆਰਡਰ ਦਿੰਦੇ ਹਾਂ ਅਤੇ ਮੈ ਤੁਹਾਡਾ ਆਰਡਰ ਰਸਤੇ ਵਿੱਚ ਫੜ੍ਹਿਆ ਸੀ ਅਤੇ ਆਉਂਦੇ ਹੋਏ ਕਿਤੇ ਮੇਰੇ ਕੋਲੋਂ ਸ਼ਾਹੀ ਪਨੀਰ ਸ਼ਾਇਦ ਡਿੱਗ ਗਿਆ ਹੈ ਅਤੇ ਹੁਣ ਮੈਂ ਤੁਹਾਨੂੰ ਦੁਬਾ ਨਵੇਂ ਆਰਡਰ ਲਈ ਕਹਿ ਨਵੇਂ ਆਰਡਰ ਲਈ ਕਹਿ ਰਿਹਾ ਹਾਂ ਕਿ ਮੇਰੇ ਨਵੇਂ ਆਰਡਰ ਵਿੱਚ ਸ਼ਾਹੀ ਪਨੀਰ ਅਤੇ ਦੋ ਠੰਡੇ ਦੀ ਬੋਤਲਾਂ ਹੋਰ ਐਡ ਕਰ ਦਿੱਤੀਆਂ ਜਾਣ ਕਿਉਂਕਿ ਤੁਹਾਡਾ ਢਾਬੇ ਦਾ ਪਨੀਰ ਬਹੁਤ ਸਵਾਦ ਹੁੰਦਾ ਹੈ ਸਾਡੇ ਸਾਰੇ ਘਰਦੇ ਬੜੇ ਹੀ ਚਾਵਾਂ ਨਾਲ ਖਾਂਦੇ ਹਨ ਅਤੇ ਮੈਨੂੰ ਦੱਸ ਦਿੱਤਾ ਜਾਵੇ ਕਿੰਨੇ ਕੁ ਟਾਇਮ ਤੱਕ ਆਰਡਰ ਆ ਜਾਵੇਗਾ ਅਤੇ ਕਿੰਨੀ ਕੁ ਪੇਮੈਂਟ ਲੱਗੇਗੀ ਤੁਹਾਨੂੰ